ਹੈਲੋ ਵੀਰ ਜੀ ਤੁਸੀਂ ਟਰਾਈਵਰ ਏਜੰਸੀ ਤੋਂ ਬੋਲ ਰਹੇ ਹੋ ਹਾਂਜੀ ਵੀਰ ਜੀ ਅਸੀਂ ਤੁਹਾਨੂੰ ਕਿਹਾ ਸੀ ਕੀ ਸਾਨੂੰ ਡਰਾਈਵਰ ਚਾਰ ਵਜੇ ਭੇਜ ਦਿਓ ਪਰ ਉਹ ਛੇ ਵੱਜ ਗਏ ਹਜੇ ਤੱਕ ਸਾਡੇ ਕੋਲ ਨਹੀਂ ਪੁੱਜਿਆ ਅਸੀਂ ਬਹੁਤ ਜ਼ਿਆਦਾ ਲੇਟ ਹੋ ਰਹੇ ਹਾਂ ਜਾਣ ਤੋਂ ਤੁਸੀਂ ਡਰਾਈਵਰ ਨੂੰ ਫੋਨ ਕਰੋ ਨਾ ਤਾਂ ਉਹ ਸਾਨੂੰ ਫੋ ਸਾਡਾ ਫੋਨ ਚੁੱਕ ਰਿਹਾ ਅਤੇ ਨਾ ਸਾਨੂੰ ਕੁਛ ਪਤਾ ਤੁਸੀਂ ਕਿਰਪਾ ਕਰਕੇ ਉਹਨੂੰ ਫੋਨ ਕਰਕੇ ਪਤਾ ਕਰੋ ਕਿ ਉਹ ਕਿਉਂ ਨਹੀਂ ਆ ਰਿਹਾ ਜੇ ਉਹਨੇ ਨਹੀਂ ਆਉਣਾ ਤਾਂ ਉਹਦੀ ਥਾਂ ਸਾਨੂੰ ਦੂਜਾ ਡਰਾਈਵਰ ਭੇਜ ਦਿੱਤਾ ਜਾਵੇ ਤਾਂ ਜੋ ਅਸੀਂ ਟਾਈਮ ਸਿਰ ਆਪਣੀ ਯਾਤਰਾ 'ਤੇ ਜਾ ਸਕੀਏ